ਸਾਡੇ ਰਾਜ ਦੇ ਵਿੱਚ ਜੋ ਪ੍ਰਮੁੱਖ ਆਗੂ ਹਨ ਉਹ ਸਾਡੇ ਗੁਰੂ ਸਾਹਿਬਾਨ ਹਨ ਜਿਨ੍ਹਾਂ ਨੇ ਸਾਨੂੰ ਇਹ ਬਲ ਬਖਸ਼ਿਆ ਹੈ ਕਿ ਅਪ ਨਾਮ ਜਪੋ ਵੰਡ ਕੇ ਛਕੋ ਅਤੇ ਕਿਰਤ ਕਰੋ ਅਤੇ ਆਪਣਾ ਦਸਵੰਧ ਬਣਾਓ ਅਤੇ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਕਿ ਜੋ ਵੀ ਹਨ ਸਭ ਇੱਕ ਹਨ ਹਿੰਦੂ ਮੁਸਲਿਮ ਸਿੱਖ ਇਸਾਈ ਇਹ ਸਭ ਆਪਸ ਦੇ ਵਿੱਚ ਭਾਈ ਭਾਈ ਹਨ ਇਹਨਾਂ ਦੇ ਵਿੱਚ ਕੋਈ ਭੇਦਭਾਵ ਨਹੀਂ ਹੈ ਅਤੇ ਜੋ ਵੀ ਤੁਹਾਡੇ ਦਰ 'ਤੇ ਆਉਂਦਾ ਕਦੇ ਉਸ ਨੂੰ ਭੁੱਖੇ ਢਿੱਡ ਨਾ ਭੇਜੋ ਸਭ ਦੇ ਨਾਲ ਹੱਸ ਖੇਡ ਕੇ ਰਲ ਮਿਲ ਕੇ ਰਹੋ ਆਪਸ ਦੇ ਵਿੱਚ ਹੱਸ ਖੇਡ ਕੇ ਰਹੋ ਕਿਸੇ ਨਾਲ ਕੋਈ ਭੇਦਭਾਵ ਨਾ ਕਰੋ ਅਤੇ ਸਭ ਨੂੰ ਆਪਣਾ ਹੀ ਮੰਨ ਕੇ ਗੁਰਸਿੱਖੀ ਮੰਨ ਕੇ ਉਸਦੇ ਨਾਲ ਹੱਸੋ ਖੇਡੋ ਅਤੇ ਰਲ ਕੇ ਰਹੋ ਅਤੇ ਗੁਰੂ ਸਾਹਿਬਾਨਾਂ ਨੇ ਇਹ ਵੀ ਸਿਖਾਇਆ ਹੈ ਕਿ ਕਦੇ ਕਿਸੇ ਦੇ ਪ੍ਰਤੀ ਕਦੇ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਅਤੇ ਆਪਣੇ ਆਪ ਦੇ ਵਿੱਚ ਇੱਕ ਚੰਗੀ ਮੱਤ ਬਖਸ਼ੋ ਜਿਸ ਨੂੰ ਜਿਹੜੀ ਮੱਤ ਨੂੰ ਆਪਾਂ ਆਪਸ ਦੇ ਵਿੱਚ ਵੰਡ ਸਕੀਏ ਕਦੇ ਵੀ ਕਿਸੇ ਨੂੰ ਗਲਤ ਰਾਹ ਦੇ ਵਿੱਚ ਚੱਲਣਾ ਅਤੇ ਜਾਂ ਜਾਣ ਨਾ ਦਿਓ ਹਰ ਕਿਸੇ ਨੂੰ ਸਹੀ ਰਾਹ ਦਿਖਾਓ ਅਤੇ ਆਪਣੇ ਆਪ ਨੂੰ ਸਹੀ ਕਰਕੇ ਦੂਜਿਆਂ ਨੂੰ ਚੰਗੀ ਮੱਤ ਬਖਸ਼ੋ ਅਤੇ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਕਿ ਕਦੇ ਵੀ ਕਿਸੇ ਨੂੰ ਮਾੜਾ ਨਾ ਬੋਲੋ ਅਤੇ ਹਰ ਇੱਕ ਨੂੰ ਇੱਕ ਸਹੀ ਰਾਹ 'ਤੇ ਲਿਜਾਉਣ ਦੀ ਬਲ ਬਖਸ਼ੋ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਕਿ ਕਦੇ ਕਿਸੇ ਦੇ ਵਿੱਚ ਫ਼ਰਕ ਨਾ ਕਰੋ ਜਦੋਂ ਤੁਹਾਡੇ ਦਰ 'ਤੇ ਕੋਈ ਭਿਖਾਰੀ ਜਾਂ ਕੁਛ ਵੀ ਕੋਈ ਭੁੱਖੇ ਢਿੱਡ ਆਉਂਦਾ ਹੈ ਉਸ ਨੂੰ ਖਾਣ ਪੀਣ ਦੇ ਲਈ ਦਿਓ ਕਿਉਂਕਿ ਗੁਰੂ ਸਾਹਿਬਾਨਾਂ ਦਾ ਲੰਗਰ ਬਹੁਤ ਹੀ ਸੋਹਣੇ ਅਤੇ ਪੂਰੇ ਪੂਰਾ ਦਿਨ ਦਿਨ ਰਾਤ ਚੱਲਦਾ ਹੈ ਜਿਸ ਕਰਕੇ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਕਿ ਦਰ 'ਤੇ ਕੋਈ ਵੀ ਆਇਆ ਉਸਨੂੰ ਕਦੇ ਭੁੱਖੇ ਢਿੱਡ ਨਾ ਭੇਜੋ ਅਤੇ ਉਸ ਨੂੰ ਇਹ ਵੀ ਬਲ ਬਖਸ਼ੋ ਕਿ ਉਹ ਅੱਗੇ ਵੀ ਕਿਸੇ ਨੂੰ ਵੀ ਕੋਈ ਵੀ ਇਨਸਾਨ ਕਿਸੇ ਨੂੰ ਵੀ ਭੁੱਖੇ ਢਿੱਡ ਨਾ ਭੇਜੇ ਅਤੇ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਕਿ ਜੋ ਵੀ ਹੱਥੀਂ ਕਿਰਤ ਕਰੋ ਕਮਾਈ ਕਰੋ ਪਰ ਕਦੇ ਵੀ ਜ਼ਿੰ ਕਦੇ ਵੀ ਪਾਪ ਨਾ ਕਰੋ ਕਿਉਂਕਿ ਸਭ ਰਲ ਮਿਲ ਕੇ ਰਹੋ ਕਿਉਂਕਿ ਆਪਸ ਦੇ ਵਿੱਚ ਜੋ ਵੀ ਹਨ ਸਭ ਗੁਰੂ ਸਾਹਿਬਾਨਾਂ ਦੇ ਹੀ ਹਨ ਸਭ ਇੱਕ ਹਨ